ਮੈਂ ਆਪਣੀ ਆਰਮੀ ਡਿਊਟੀ ਦੇ ਦੌਰਾਨ ਘੱਟੋ ਘੱਟ ਅਠਤਾਲੀ ਘੰਟੇ ਦੀ ਚੜ੍ਹਾਈ ਯਾਤਰਾ ਕੀਤੀ ਜਿਸਦਾ ਮੇਨ ਮਕਸਦ ਸਾਡਾ ਅੱਤਵਾਦੀਆਂ ਨਾਲ਼ ਮੁਕਾਬਲਾ ਕਰਨਾ ਸੀ ਉਸ ਦੀ ਸੂਹ 'ਤੇ ਮਿਲਣ 'ਤੇ ਅਸੀਂ ਉੱਥੇ ਗਏ ਸੀ ਉੱਥੇ ਅਸੀਂ ਘੱਟੋ ਘੱਟ ਦੋ ਦਿਨ ਅਠਤਾਲੀ ਘੰਟੇ ਰਹੇ ਉੱਥੇ ਉੱਥੇ ਸਾਡਾ ਅੱਤਵਾਦੀਆਂ ਨਾਲ਼ ਮੁਕਾਬਲਾ ਹੋਇਆ ਅਤੇ ਵਿੱਚੋਂ ਅੱਤਵਾਦੀਆਂ ਨੂੰ ਸਾਰਿਆਂ ਨੂੰ ਮਾਰ ਮੁਕਾਇਆ ਅਤੇ ਉਹਦੇ ਵਿੱਚੋਂ ਮੇਨ ਮਕਸਦ ਜੋ ਸਾਡੇ ਦਿਲ ਵਿੱਚ ਸੀ ਅਸੀਂ ਜਦੋਂ ਅਸੀਂ ਆਪਾਂ ਸੋਚਦੇ ਸੀ ਕਿਤੇ ਕਿਤੇ ਟੀ ਵੀ 'ਤੇ ਦੇਖਦੇ ਸੀ ਵੀ ਇਹ ਕਿਵੇਂ ਹੁੰਦਾ ਕਿਵੇਂ ਨਹੀਂ ਕਿਵੇਂ ਦਿਲ 'ਚ ਡਰ ਹੁੰਦਾ ਉੱਥੋਂ ਅਸੀਂ ਜਦੋਂ ਦੋ ਦਿਨ ਅੱਤਵਾਦੀਆਂ ਨਾਲ਼ ਮੁਕਾਬਲਾ ਚੱਲਦਾ ਰਿਹਾ ਉਹ ਚੱਲਣ ਤੋਂ ਬਾਅਦ ਸਾਡੇ ਸਰੀਰ ਦਾ ਮਨ ਦਾ ਜੋ ਡਰ ਹੁੰਦਾ ਉਹ ਨਿਕਲਿਆ ਅਤੇ ਉੱਥੇ ਅਸੀਂ ਇਹ ਸਿੱਖਿਆ ਕਿ ਅ ਅਸੀਂ ਆਪਣੇ ਦੇਸ਼ ਬਾਰੇ ਕਿੱਥੋਂ ਕੀ ਗਲਤੀ ਕਿਉਂ ਹੋਈ ਸੀ ਉਹਨੂੰ ਅੱਗੋਂ ਗਲਤੀ ਨਾ ਦੁਬਾਰਾ ਦੁਹਰਾਈ ਜਾਵੇ ਅਤੇ ਆਪਣੇ ਦੇਸ਼ ਵਾਸਤੇ ਕੁਛ ਕਰੀਏ ਅਤੇ ਸਾਰਾ ਮੰਨ ਲਉ ਉੱਥੋਂ ਡਰ ਰਹਿ ਗਿਆ ਸਾਡਾ